ਸਾਡੇ ਕੋਲਜ ਵਿੱਚ ਹਰ ਸਾਲ ਇਹ ਕੋਈ ਨਾ ਕੋਈ ਯੂਥ ਫੈਸਟੀਵਲ ਮਨਾਇਆ ਜਾਂਦਾ ਸੀ ਅਤੇ ਇਸ ਸਾਲ ਵੀ ਦੋ ਹਜ਼ਾਰ ਚੌਵੀ ਵਾਲੇ ਸਾਲ ਵੀ ਨਵੇਂ ਸਾਲ ਵਾਲੇ ਦਿਨ ਸਾਡੇ ਕੋਲਜ ਵਿੱਚ ਇੱਕ ਕੋਂਪੀਟੀਸ਼ਨ ਗਾਇਕੀ ਦਾ ਹੋਇਆ ਸੀ ਜਿਸ ਵਿੱਚ ਮੈਂ ਕੋਂਪੀਟੀਸ਼ਨ ਵਿੱਚ ਭਾਗ ਲਿਆ ਸੀ ਅਤੇ ਉਸ ਵਿੱਚ ਗਾਉਣ ਦੀ ਮੈਂ ਬਹੁਤ ਜ਼ਿਆਦਾ ਤਿਆਰੀ ਕੀਤੀ ਹੋਈ ਸੀ ਘਰੋਂ ਵੀ ਕਰਕੇ ਗਿਆ ਸੀ ਅਤੇ ਸਕੂਲੇ ਵੀ ਕਰਕੇ ਗਿਆ ਸੀ ਅਤੇ ਪਰਫੋਰਮੈਂਸ ਤੋਂ ਪਹਿਲਾਂ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਗਾਣਾ ਸੁਣਾਇਆ ਅਤੇ ਉਹ ਬਹੁਤ ਪ੍ਰਭਾਵਿਤ ਹੋਏ ਮੇਰੇ ਗਾਣੇ ਤੋਂ ਉਹਨਾਂ ਨੇ ਮੈਨੂੰ ਹੌਸਲਾ ਅਫਜ਼ਾਈ ਦਿੱਤੀ ਕਿ ਗਾਣਾ ਜਾ ਕੇ ਬੋਲ ਜਦੋਂ ਮੈਂ ਸਟੇਜ 'ਤੇ ਚੜ੍ਹਿਆ ਤਾਂ ਮੈਂ ਇੱਕੋ ਦਮ ਘਬਰਾ ਗਿਆ ਕਿ ਇੰਨੇ ਸਾਰੇ ਲੋਕਾਂ ਵਿੱਚ ਮੈਂ ਗਾਣਾ ਕਿਵੇਂ ਗਾਵਾਂ ਜਦੋਂ ਮੈਂ ਗਾਣਾ ਗਾਇਆ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ ਗਾਣਾ ਉਹ ਲੋਕਾਂ ਨੇ ਤਾੜੀਆਂ ਮਾਰੀਆਂ ਅਤੇ ਮੈਂ ਖੁਸ਼ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਇੱਕ ਹੋਰ ਗਾਣਾ ਗਾਇਆ ਜਿਹੜਾ ਕਿ ਮੇਰੇ ਦਿਲੀ ਕਰੀਬ ਸੀ ਗਾਣਾ ਗਾਉਣ ਤੋਂ ਬਾਅਦ ਉਹਨਾਂ ਨੇ ਫਿਰ ਤਾੜੀਆਂ ਮਾਰੀਆਂ ਅਤੇ ਮੈਨੂੰ ਸਨਮਾਨਿਤ ਕੀਤਾ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਉੱਥੋਂ ਦੇ ਨੇ ਸਨਮਾਨਿਤ ਕਰਕੇ ਮੈਨੂੰ ਆਪਣੇ ਘਰ ਭੇਜ ਦਿੱਤਾ